ਭੰਗੜੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਭੰਗੜੇ ਦੀਆਂ ਕਈ ਤਾਨ ਹੁੰਦੀਆਂ ਹਨ ਲੁੱਡੀ ਝੂਮਰ ਗੰਡਾਸਾ ਆਦਿ ਭੰਗੜੇ ਪੰਜਾਬ ਤੋਂ ਇਲਾਵਾ ਸਾਰੀ ਦੁਨੀਆਂ ਭਰ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ

ਤਿਉਹਾਰ ਵਿੱਚ ਵਿਸਾਖੀ ਲੋਹੜੀ ਵਿੱਚ ਵ ਭੰਗੜੇ ਨੂੰ ਪਹਿਲ ਦਿੱਤੀ ਜਾਂਦੀ ਹੈ ਹਰ ਖੁਸ਼ੀ ਦੇ ਮੌਕੇ 'ਤੇ ਭੰਗੜੇ ਭੰਗੜੇ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ ਇਸ ਲਈ ਭੰਗੜੇ ਦੀ ਪੰਜਾਬ ਅਤੇ ਦੁਨੀਆਂ ਭਰ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ